ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਜੀ ਹੋਰ ਬਸ ਠੀਕ ਹੈ ਹਾਂਜੀ ਮੈਮ ਹੋ ਗਈ ਜੀ ਤਿਆਰੀ ਤੁਹਾਡੇ ਬੱਚਿਆਂ ਦੀ ਠੀਕ ਹੈ ਜੀ ਠੀਕ ਹੈ ਜੀ ਮੈਮ ਉਨ੍ਹਾਂ ਨੇ ਨਾ ਉਹ ਸੋਂਗ ਪਰ ਸੰ ਗਾਣੇ ਪਰ ਮਤਲਬ ਕਿ ਡਾਂਸ ਕਰਨਾ ਹੈ ਟਰੈਂਗਲ ਹੀ ਕੱਪੜੇ ਪਾ ਕੇ ਆਉਣੇ ਆ ਉਨ੍ਹਾਂ ਨੇ ਜਿਵੇਂ ਇੰਡੀਆ ਦੇ ਉੱਪਰ ਹਾਂਜੀ ਯੇ ਮੇਰਾ ਇੰਡੀਆ ਹਾਂਜੀ ਹਾਂਜੀ ਹਾਂਜੀ ਜੀ ਸਿਖਾਤਾ ਜੀ ਹੋ ਗਈ ਤਿਆਰੀ ਇਨ੍ਹਾਂ ਦੀ ਹਾਂਜੀ ਮੈਮ ਸਕੂਲ ਵਿੱਚ ਪ੍ਰੋਗਰਾਮ ਨੌਂ ਵਜੇ ਤੋਂ ਸਟਾਟ ਹੈਗਾ ਪਹਿਲਾਂ ਛੋਟੇ ਬੱਚਿਆਂ ਦਾ ਮਤਲਬ ਕਿ ਇਹ ਪਰੇਡ ਕਰੂੰਗੇ ਤੁਹਾਡੇ ਵਾਲੇ ਹਾਂਜੀ ਅਤੇ ਫਿਰ ਉਸ ਤੋਂ ਬਾਅਦ ਮਤਲਬ ਕਿ ਜਿਹੜੇ ਬੜੇ ਬੱਚੇ ਇਹ ਡਾਂਸ ਕਰੂੰਗੇ ਫਿਰ ਉਸ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਝੰਡਾ ਲਹਿਰਾਊਂਗੇ ਹਾਂਜੀ ਅਤੇ ਫਿਰ ਓਹ ਤੋਂ ਬਾਅਦ ਮਤਲਬ ਕਿ ਬੱਚਿਆਂ ਦਾ ਟੀਚਰਾਂ ਪੂਰੇ ਸਟਾਫ ਦਾ ਮੂੰਹ ਮਿੱਠਾ ਕਰਵਾਉਂਗੇ ਹਾਂਜੀ ਹਾਂਜੀ ਹੋਵੇਗੀ ਕਿਉਂਕਿ ਬੱਚਿਆਂ ਨੇ ਫਿਰ ਅੱਜ ਥੱਕ ਜਾਣਾ ਜੇ ਪ੍ਰੋਗਰਾਮ ਉਨ੍ਹਾਂ ਨੇ ਕਰਨਾ ਏ ਤਿਆਰੀ ਕਰਕੇ ਆਊਂਗੇ ਸਾਰਾ ਦਿਨ ਲਗ ਉਹਦੇ ਕਰਕੇ ਰੈਸਟ ਦੇਣੀ ਉਨ੍ਹਾਂ ਨੂੰ ਤਾਂ ਛੁੱਟੀ ਹੀ ਹੋਵੇਗੀ ਹਾਂਜੀ ਠੀਕ ਹਾਂਜੀ ਓਕੇ ਜੀ ਠੀਕ ਹੈ ਜੀ